ਸਤਿ ਸ਼੍ਰੀ ਅਕਾਲ ਜੀ ਤੁਸੀਂ ਰਾਮ ਢਾਬੇ ਤੋਂ ਬੋਲ ਰਹੇ ਹੋ ਮੈਂ ਅਰਸ਼ਦੀਪ ਬੋਲਦਾ ਹਾਂ ਆਈ ਆਈ ਟੀ ਰੋਪੜ ਤੋਂ ਜੀ ਮੈਂ ਆਰਡਰ ਕਰ ਇੱਕ ਆਰਡਰ ਕਰਵਾਇਆ ਸੀ ਜਿਹਦੇ ਵਿੱਚ ਦੋ ਮੋਮੋਸ ਦੋ ਮਨਚੂਰੀਅਨ ਇੱਕ ਪੀਜ਼ਾ ਅਤੇ ਇੱਕ ਸੈਂਡਵਿਚ ਸ਼ਾਮਿਲ ਸੀ ਪਹਿਲਾਂ ਅਸਲ ਦੇ ਵਿੱਚ ਮੇਰੇ ਮਾਮਾ ਜੀ ਅਤੇ ਮਾਮੀ ਜੀ ਸਮੇਤ ਪਰਿਵਾਰ ਆਉਣ ਲੱਗੇ ਸਨ ਲੇਕਿਨ ਮੈਨੂੰ ਹੁਣ ਪਤਾ ਲੱਗਾ ਕਿ ਮੇਰੇ ਨਾਨਾ ਅਤੇ ਨਾਨੀ ਜੀ ਵੀ ਆ ਰਹੇ ਹਨ ਜਿਸ ਕਰਕੇ ਮੈਂ ਆਰਡਰ ਦੇ ਵਿੱਚ ਪੰਜ ਰੋਟੀਆਂ ਇੱਕ ਦਾਲ ਇੱਕ ਸ਼ਾਹੀ ਪਨੀਰ ਦੋ ਗੁਲਾਬ ਜਾਮਣ ਵੀ ਸ਼ਾਮਿਲ ਕਰਵਾਉਣਾ ਚਾਹੁੰਦਾ ਹਾਂ ਅਤੇ ਪੈਸੇ ਮੈਂ ਔਨਲਾਈਨ ਟਰਾਂਸਫਰ ਕਰ ਦਿੰਦਾ ਹਾਂ ਧੰਨਵਾਦ